ਜੀ ਹਾਂ ਪੇਂਟਿੰਗ ਵਿੱਚ ਰਸਮੀ ਸਿੱਖਿਆ ਸੀ ਮੈਨੂੰ ਪੇਂਟਿੰਗ ਦਾ ਬਹੁਤ ਹੀ ਸ਼ੌਕ ਹੈ ਮੈਨੂੰ ਪੇਂਟਿੰਗ ਵਿੱਚ ਦਿਲਚਸਪੀ ਵੀ ਬਹੁਤ ਹੈ ਪੇਂਟਿੰਗ ਨੂੰ ਸੋਹਣੇ ਤਰੀਕੇ ਦੇ ਨਾਲ ਸੋਹਣੇ ਰੰਗਾਂ ਦੇ ਨਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਪੇਂਟਿੰਗ ਕਰਨਾ ਵੀ ਇੱਕ ਕਲਾ ਹੈ ਕਿਸੇ ਚੀਜ਼ ਨੂੰ ਦੇਖ ਕਰ ਉਸ ਭਾਵਾਂ ਨੂੰ ਉਹ ਆਪਣੇ ਭਾਵਾਂ ਨੂੰ ਆਪਣੇ ਭਾਵਾਂ ਰਾਹੀਂ ਉਹਨੂੰ ਬਿਆਨ ਕਰਨਾ ਬਹੁਤ ਵੱਡੀ ਗੱਲ ਹੈ ਪੇਂਟਿੰਗ ਦੀ ਸਿਖਲਾਈ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕੋਈ ਵੀ ਆਪਾਂ ਕਿਸੇ ਵੀ ਪੇਂਟਿੰਗ ਨੂੰ ਕਰਕੇ ਸੋਹਣੇ ਤਰੀਕੇ ਦੇ ਨਾਲ ਆਪਾਂ ਉਸਨੂੰ ਪੇਸ਼ ਕਰ ਸਕਦੇ ਹਾਂ ਸਿਖਲਾਈ ਇਸ ਦੀ ਬਹੁਤ ਹੀ ਜ਼ਰੂਰੀ ਹੈ ਆਪਾਂ ਇਸਨੂੰ ਸੋਹਣੇ ਤਰੀਕੇ ਦੇ ਨਾਲ ਸਿੱਖ ਕੇ ਇਸ ਨੂੰ ਅੱਗੇ ਸਿਖਲਾਈ ਦੇ ਸਕਦੇ ਹਾਂ ਅੱਗੇ ਹੋਰ ਵੀ ਲੋਕਾਂ ਨੂੰ ਸਿਖਾ ਸਕਦੇ ਹਾਂ ਜੇ ਆਪ ਨੂੰ ਵਧੀਆ ਤਰੀਕੇ ਦੇ ਨਾਲ ਆਈ ਜਾਵੇਗੀ ਪੇਂਟਿੰਗ ਤਾਂ ਆਪਾਂ ਹੋਰ ਚਾਰ ਲੋਕਾਂ ਨੂੰ ਚਾਰ ਮੈਂਬਰਸ ਨੂੰ ਅੱਗੇ ਸਿਖਲਾਈ ਦੇ ਸਕਦੇ ਹਾਂ ਇੱਕ ਤਾਂ ਕੀ ਹੈ ਆਪਣਾ ਹੱਥ ਦਾ ਇੱਕ ਹੁਨਰ ਹੈ ਔਰ ਦੂਸਰਾ ਇਸਨੂੰ ਆਪਾਂ ਸੋਹਣੇ ਤਰੀਕੇ ਦੇ ਨਾਲ ਕਰਕੇ ਇੱਕ ਬਿਜਨਸ ਵੀ ਚਲਾ ਸਕਦੇ ਹਾਂ